ਸਾਡੇ ਖੇਤਰ ਵਿੱਚ ਟਰਾਂਸਪੋਰਟ ਦੀਆਂ ਬਹੁਤ ਸਾਰੀਆਂ ਆਪਸ਼ਨ ਮਿਲ ਜਾਂਦੀਆਂ ਜੀ ਇੱਥੇ ਜਿਵੇਂ ਕਿ ਆਪਣਾ ਪੰਜਾਬ ਰੋਡਵੇਜ ਹੋ ਗਈ ਸੀ ਟੀ ਯੂ ਹੋ ਗਿਆ ਕੈਬਸ ਵਗੈਰਾ ਹੋ ਗਈਆਂ ਇਹ ਸਾਰੀਆਂ ਹੀ ਜਿਹੜੇ ਟਰਾਂਸਪੋਰਟ ਸਹੂਲਤਾਂ ਸਾਰੀਆਂ ਲੋਕ ਆਪਣੇ ਆਪਣੇ ਲੋੜ ਦੇ ਅਨੁਸਾਰ ਵਰਤਦੇ ਆ ਜੀ ਇਹ ਸਾਰੀਆਂ ਹੀ ਕਿਫਾਇਤੀ ਹੈ ਸਸਤੀਆਂ ਅਤੇ ਭਰੋਸੇਮੰਦ ਹੈ ਜੀ ਮੰਨ ਲਉ ਤੁਸੀਂ ਕਿਤੇ ਲੋਕਲ ਜਾਣਾ ਤਾਂ ਕੈਬ ਵਗੈਰਾ ਔਨਲਾਈਨ ਬੁੱਕ ਹੋ ਜਾਂਦੀ ਹੈ ਜੀ ਤੁਹਾਨੂੰ ਪਰ ਕਿਲੋਮੀਟਰ ਦੇ ਹਿਸਾਬ ਨਾਲ ਪੰਜ ਕਿਲੋਮੀ ਪੰਜ ਰੁਪਏ ਪਰ ਕਿਲੋਮੀਟਰ ਚਾਰਜ ਕਰਦੇ ਹੈ ਜੀ ਇਸ ਤੋਂ ਇਲਾਵਾ ਜੋ ਪੰਜਾਬ ਰੋਡਵੇਜ਼ ਦੀ ਬੱਸ ਹੈ ਉਹਦਾ ਸਰਕਾਰੀ ਰੇਟ ਦੇ ਹਿਸਾਬ ਨਾਲ ਦਸ ਰੁਪਏ ਪਰ ਸਟੇਸ਼ਨ ਹੈ ਜੀ ਉਹਦਾ ਸੀ ਟੀ ਯੂ ਦਾ ਵੀ ਇੱਦਾਂ ਹੀ ਹੈ ਜੀ ਇਹ ਭਰੋਸੇਮੰਦ ਵੀ ਨੇ ਕਿਉਂਕਿ ਲੋਕਲ ਡਰਾਈਵਰ ਨੇ ਜੀ ਵਧੀਆ ਗੱਡੀਆਂ ਜਦੋਂ ਕਰਦੇ ਭਰੋਸੇਮੰਦ ਹਨ ਜਿੰਨਾ ਚਿਰ ਬੰਦੇ ਦਾ ਆਪਾਂ ਇੱਕ ਔਨਲਾਈਨ ਇੰਟਰਵਿਊ ਹੁੰਦਾ ਹੈ ਕੈਬ ਵਾਲਿਆਂ ਦਾ ਓਨਾ ਚਿਰ ਉਹਨਾਂ ਨੂੰ ਗੱਡੀ ਨਹੀਂ ਲੱਗਦੀ ਜਿਹਦੇ 'ਚ ਜੀ ਇੱਦਾਂ ਆਟੋ ਰਿਕਸ਼ਾ ਵਗੈਰਾ ਹੋ ਗਏ ਟੂ ਵੀਲਰ ਵੀ ਹੁਣ ਅੱਜ ਦੇ ਸਮੇਂ ਵਿੱਚ ਟੂ ਵੀਲਰ ਹੈ ਜੋ ਉਹ ਵੀ ਜਿੱਦਾਂ ਟਰਾਂਸਪੋਰਟ ਵਿੱਚ ਐਡ ਕੀਤਾ ਗਿਆ ਜੀ ਜੇ ਤੁਸੀਂ ਸਿੰਗਲ ਪਰਸਨ ਹੋ ਤਾਂ ਟੂ ਵੀਲਰ ਵੀ ਬੁੱਕ ਕਰਵਾ ਸਕਦੇ ਹੋ ਲੋਕਲ ਜਾਣ ਲਈ